ਹੈਲੋ ਹਾਂਜੀ ਵੀਰ ਜੀ ਕਿੱਥੇ ਰਹਿ ਗਏ ਹੋ ਤੁਸੀਂ ਹਾਂਜੀ ਮੈਂ ਕੈਬ ਬੁੱਕ ਕੀਤੀ ਸੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਜਿਹੜਾ ਤੁਹਾਡੇ ਪਿਕਅੱਪ ਸਥਾਨ ਦੇ ਉੱਤੇ ਪਹੁੰਚ ਗਿਆ ਹਾਂ ਪਰ ਤੁਸੀਂ ਮੈਨੂੰ ਸ਼ਾਇਦ ਦੇਖ ਦੀ ਸਕ ਰਹੇ ਹੋ ਮੈਂ ਤੁਹਾਨੂੰ ਇਸ ਲਈ ਕੋਲ ਕੀਤੀ ਕਿ ਮੈਂ ਜਿਹੜਾ ਹੈਗਾ ਆਈ ਆਈ ਟੀ ਦੇ ਮੇਨ ਦਰਵਾਜ਼ੇ ਦੇ ਉੱਤੇ ਖੜ੍ਹਾ ਹਾਂ ਪਰ ਤੁਸੀਂ ਮੈਨੂੰ ਲੱਭ ਨਹੀਂ ਰਹੇ ਹੋ ਅਤੇ ਤੁਸੀਂ ਮੈਨੂੰ ਆਪਣਾ ਸਹੀ ਠਿ ਟਿਕਾਣਾ ਦੱਸ ਸਕਦੇ ਹੋ ਕਿ ਤੁਸੀਂ ਕਿੱਥੇ ਹੋ ਮੈਂ ਤੁਹਾਨੂੰ ਲੋਕੇਸ਼ਨ ਆਪਣੀ ਵੀ ਸੈਂਡ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਉੱਥੇ ਤੋਂ ਅਤੇ ਮੈਨੂੰ ਮੇਰੇ ਸਹੀ ਸਥਾਨ 'ਤੇ ਆ ਕੇ ਮੈਨੂੰ ਪਿਕਅੱਪ ਕਰ ਲਉ ਕਿਉਂਕਿ ਮੈਂ ਇੱਕ ਜ਼ਰੂਰੀ ਕੰਮ ਦੇ ਉੱਤੇ ਜਾਣਾ ਹੈ ਅਤੇ ਮੌਸਮ ਬੜਾ ਖਰਾਬ ਹੈ ਅਤੇ ਮੈਨੂੰ ਲੱਗਦਾ ਕਿ ਰਸਤੇ ਦੇ ਵਿੱਚ ਜਾਮ ਵੀ ਆਪਾਂ ਨੂੰ ਮੌਜੂਦ ਮਿਲੂਗਾ ਅਤੇ ਆਪਾਂ ਚੰਡੀਗੜ੍ਹ ਲਈ ਜਾਣਾ ਅਤੇ ਇੱਕ ਘੰਟਾ ਸਾਨੂੰ ਲੱਗ ਜੇਗਾ ਰਸਤੇ ਦੇ ਵਿੱਚ ਪਰ ਸਾਨੂੰ ਲੱਗਦਾ ਹੈ ਕਿ ਸਾਨੂੰ ਛੇਤੀ ਨਿਕਲਣਾ ਚਾਹੀਦਾ ਇਸ ਲਈ ਮੇਰੇ ਦੱਸੇ ਹੋਏ ਸਥਾਨ ਦੇ ਉੱਤੇ ਪਹੁੰਚਣ ਦੀ ਕ੍ਰਿਪਾਲਤਾ ਕਰੋ ਠੀਕ ਹੈ ਜੀ ਸ਼ੁਕਰੀਆ